ਸੱਭਿਆਚਾਰ ਨੂੰ ਕਾਇਮ ਰੱਖਣ ਲਈ ਸਾਨੂੰ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬ ਵਿੱਚ ਬਹੁਤ ਤਿਉਹਾਰ ਆਉਂਦੇ ਹਨ ਜਿਹਨਾਂ ਦਾ ਅਨੰਦ ਸਾਨੂੰ ਮਾਣਨਾ ਚਾਹੀਦਾ ਹੈ ਜਿੱਥੇ ਸਾਰੇ ਰਲ ਕੇ ਇਕੱਠੇ ਹੋ ਕੇ ਪੰਜਾਬੀ ਵਿੱਚ ਗੱਲਬਾਤ ਕਰਦੇ ਹਨ ਸਾਡੇ ਸੱਭਿਆਚਾਰਕ ਵਿਰਸੇ ਜਿਵੇਂ ਕੁੜੀਆਂ ਤੀਆਂ ਲਗਾਉਂਦੀਆਂ ਹਨ ਗਿੱਧਾ ਪਾਉਂਦੀਆਂ ਹਨ ਸੱਥ ਵਿੱਚ ਬੈਠ ਕੇ ਬਜ਼ੁਰਗ ਗੱਲ ਪੰਜਾਬੀ ਵਿੱਚ ਕਰਦੇ ਹਨ ਸ਼ੁੱਧ ਪੰਜਾਬੀ ਬੋਲਦੇ ਹਨ ਔਰਤਾਂ ਰਲ ਕੇ ਚਰਖਾ ਕੱਤਦੀਆਂ ਹਨ ਅਤੇ ਪੰਜਾਬੀ ਬੋਲਦੀਆਂ ਹਨ ਅਤੇ ਹੱਸਦੀਆਂ ਖੇਡਦੀਆਂ ਹਨ ਮੌਜੂਦਾ ਪੀੜ੍ਹੀਆਂ ਵਿੱਚ ਸਾਨੂੰ ਚਾਹੀਦਾ ਹੈ ਆਪਣੀ ਗੱਲਬਾਤ ਇੱਕ ਦੂਸਰੇ ਨਾਲ ਪੰਜਾਬੀ ਵਿੱਚ ਹੀ ਕਰੀਏ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ ਵਿੱਚ ਦਾਖਲ ਕਰਾਈਏ ਜਿੱਥੇ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਵਰਤੀ ਜਾਂਦੀ ਹੋਵੇ ਅਤੇ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖੀਏ ਤਾਂ ਜੋ ਪੰਜਾਬੀ ਭਾਸ਼ਾ ਨੂੰ ਕਾਇਮ ਰੱਖਿਆ ਜਾ ਸਕੇ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ ਪੜ੍ਹਨੀ ਅਤੇ ਪੈਂਤੀ ਸਿਖਾਈਏ ਆਪਣੇ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ ਪਰਿਵਾਰ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ ਮੁਹੱਲੇ ਵਿੱਚ ਪੰਜਾਬੀ ਬੋਲੋ ਪਿੰਡ ਵਿੱਚ ਹਮੇਸ਼ਾ ਪੰਜਾਬੀ ਦੀ ਵਰਤੋਂ ਕਰੋ ਪੰਜਾਬੀ ਵਿੱਚ ਹੀ ਗੱਲ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਪੰਜਾਬੀ ਤੋਂ ਵਾਂਝੀਆਂ ਨਾ ਰਹਿਣ ਅਤੇ ਉਹਨਾਂ ਨੂੰ ਪੰਜਾਬੀ ਸੱਭਿਆਚਾਰਕ ਬਾਰੇ ਗਿਆਨ ਕਰਾਇਆ ਜਾਵੇ ਅਤੇ ਪੰਜਾਬੀ ਨਾਲ ਹਮੇਸ਼ਾ ਲਈ ਜੋੜਿਆ ਜਾ ਸਕੇ